ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਟਰਾਂਸਪੋਰਟ ਏਜੰਸੀ ਉਬਰ ਤੋਂ ਗੱਲ ਕਰ ਰਹੇ ਹੋ ਜੀ ਮੈਨੂੰ ਇੱਕ ਕੈਬ ਬੁੱਕ ਕਰਵਾਉਣੀ ਹੈ ਹਾਂਜੀ ਜੀ ਕੈਬ ਚਾਹੀਦੀ ਸੀ ਇੱਕ ਜੀ ਆਪਣੇ ਪਰਿਵਾਰ ਦੇ ਨਾਲ ਬਸ ਜੰਮੂ ਦੀ ਯਾਤਰਾ ਵਾਸਤੇ ਜਾਣਾ ਸੀ ਇਸ ਵਾਸਤੇ ਚਾਹੀਦੀ ਸੀ ਹਾਂਜੀ ਜੇ ਤੁਸੀਂ ਦੱਸ ਦਿਓ ਤਾਂ ਪਰ ਕਿਲੋਮੀਟਰ ਕਿੰਨਾ ਚਾਰਜ ਤੁਸੀਂ ਲੈ ਰਹੇ ਨੇ ਜੀ ਦਸ ਰੁਪਏ ਤਾਂ ਪਰ ਕਿਲੋਮੀਟਰ ਦੇ ਹਿਸਾਬ ਨਾਲ ਜ਼ਿਆਦਾ ਨੇ ਤੁਸੀਂ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਨਾ ਥੋੜ੍ਹਾ ਜਿਹਾ ਨਹੀਂ ਨਹੀਂ ਦਸ ਰੁਪਏ ਪਰ ਕਿਲੋਮੀਟਰ ਦੇ ਕਾਫੀ ਜ਼ਿਆਦਾ ਨੇ ਤੁਸੀਂ ਸਹੀ ਲਗਾ ਲਓ ਕੋਈ ਡਿਸਕਾਊਂਟ ਵਗੈਰਾ ਹਾਂਜੀ ਜੀ ਜੀ ਜੀ ਮੈਂ ਪਹਿਲਾਂ ਵੀ ਤੁਹਾਡੀ ਏਜੰਸੀ ਤੋਂ ਲਗਾਤਾਰ ਕਾਫੀ ਵਾਰੀ ਮੈਂ ਆਹ ਕੈਬ ਬੁੱਕ ਕਰਵਾਈ ਹੈਗੀ ਐ ਹਾਂਜੀ ਜੀ ਬਿਲਕੁਲ ਸਹੀ ਪਰ ਜੀ ਨਿਯਮਤ ਗ੍ਰਾਹਕ ਹੈਗੇ ਆਂ ਤੁਹਾਡੇ ਅਸੀਂ ਅਤੇ ਜੇ ਤੁਸੀਂ ਸਹੀ ਲਗਾ ਲਓ ਤਾਂ ਸਾਨੂੰ ਕੈਬ ਚਾਹੀਦੀ ਹੈਗੀ ਐ ਹਾਂਜੀ ਬਿਲਕੁਲ ਜੀ ਬਸ ਪੈਸੇ ਵੀ ਸਹੀ ਹੋਣ ਅਤੇ ਯਾਤਰਾ ਸਾਡੀ ਸ ਬਿਲਕੁਲ ਸੁਖਾਲੀ ਹੋਜੇਗੀ ਹਾਂਜੀ ਜੀ ਨਹੀਂ ਬਹੁਤ ਤੁਹਾਡਾ ਧੰਨਵਾਦ ਹੋਏਗਾ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਸੱਤ ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਜੇ ਲਗਾ ਲਓ ਤਾਂ ਬਸ ਡਰਾਈਵਰ ਵੀ ਤੁਸੀਂ ਥੋੜ੍ਹਾ ਵਧੀਆ ਜਿਹਾ ਹੀ ਭੇਜਿਉ ਕਿਉਂਕਿ ਫੈਮਲੀ ਦੇ ਨਾਲ ਅਸੀਂ ਜਾਣਾ ਹੈ ਅਤੇ ਜਿਹਦੇ ਕਰਕੇ ਸਾਰਿਆਂ ਨੂੰ ਥੋੜ੍ਹੀ ਜਿਹੀ ਸਹੂਲਤ ਹੀ ਰਹੇ ਹਾਂਜੀ ਡਰਾਈਵਿੰਗ ਵਧੀਆ ਹੋਵੇ ਉਹਦੀ ਐਕਸਪੀਰੀਅਸ ਡਰਾਈਵਰ ਹੀ ਭੇਜਿਉ ਤੁਸੀਂ ਹਾਂਜੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂਜੀ ਅਸੀਂ ਪਹਿਲਾਂ ਵੀ ਤੁਹਾਡੀ ਏਜੰਸੀ ਤੋਂ ਉਬਰ ਕ ਕਾਫੀ ਵਾਰੀ ਬੁੱਕ ਕਰਵਾਈ ਹੈਗੀ ਐ ਹਾਂਜੀ ਕੈਬ ਬੁੱਕ ਕਰਵਾਈ ਹੈ ਨਹੀਂ ਜੀ ਪਹਿਲਾਂ ਤਾਂ ਕੋਈ ਸਾਨੂੰ ਕਦੀ ਕੋਈ ਕੰਪਲੇਂਟ ਨਹੀਂ ਲੱਗੀ ਅਤੇ ਇਸ ਕਰਕੇ ਅਸੀਂ ਦੁਬਾਰਾ ਮੈਂ ਚੌਥੀ ਪੰਜਵੀਂ ਵਾਰੀ ਤੁਹਾਡੇ ਏਜੰਸੀ ਤੋਂ ਕੈਬ ਬੁਕ ਕਰਵਾ ਰਹੀ ਹਾਂ ਹਾਂਜੀ ਜੀ ਨਹੀਂ ਜੀ ਤੁਹਾਡਾ ਵੀ ਧੰਨਵਾਦ ਦੇਖੋ ਜੀ ਜੇ ਬਿਲਕੁਲ ਡਰਾਈਵਰ ਸਹੀ ਡਰਾਈਵਿੰਗ ਕਰਦਾ ਹੈ ਅਤੇ ਕਸਟਮਰ ਦੇ ਨਾਲ ਤੁਸੀਂ ਸਹੀ ਬੀਹੇਵਅਰ ਕਰਦੇ ਹੋ ਤਾਂ ਔਰ ਜੇ ਪਰ ਕਿਲੋਮੀਟਰ ਦੇ ਹਿਸਾਬ ਨਾਲ ਸਹੀ ਚਾਰਜਿਸ ਲੈਂਦੇ ਹੋ ਤਾਂ ਜ਼ਰੂਰ ਕਸਟਮਰ ਦੁਬਾਰਾ ਉਸ ਜਗ੍ਹਾ ਤੋਂ ਜਾਂਦਾ ਹੈਗਾ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਅਤੇ ਤੁਸੀਂ ਇਸ ਤਰ੍ਹਾਂ ਕਰਿਓ ਕਿ ਸਾਨੂੰ ਹਾਂਜੀ ਜੀ ਕੱਲ੍ਹ ਅਰਲੀ ਮੋਰਨਿੰਗ ਸਿਕਸ ਓ ਕਲੋਕ ਤੁਸੀਂ ਕੈਬ ਭੇਜ ਸਕਦੇ ਹੋ ਹਾਂਜੀ ਜੀ ਠੀਕ ਹੈ ਹਾਂਜੀ ਬਸ ਐਕਸਪੀਰੀਅੰਸ ਡਰਾਈਵਰ ਹੀ ਭੇਜਿਓ ਤੁਸੀਂ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਤਾਂ ਫਿਰ ਠੀਕ ਹੈ ਡਨ ਰਿਹਾ ਕਿ ਸੱਤ ਰੁਪਈਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਹਾਂਜੀ ਮੈਂ ਤੁਹਾਨੂੰ ਅਡਰੈਸ ਦੱਸ ਦਿੰਦੀ ਹਾਂ ਸਰਦਾਰ ਬਲਜੀਤ ਸਿੰਘ ਹਾਂਜੀ ਗਲੀ ਸ਼ਹੀਦ ਭਗਤ ਸਿੰਘ ਦੀ ਹਾਂਜੀ ਗਲੀ ਨੰਬਰ ਪੰਜ ਹਾਂਜੀ ਅੰਮ੍ਰਿਤਸਰ ਰੋਡ ਵੱਲ ਪੈ ਜਾਂਦਾ ਹੈਗਾ ਹਾਂਜੀ ਤੁਸੀਂ ਹਾਂਜੀ ਜੀ ਸਵੇਰੇ ਤੁਸੀਂ ਅਰਲੀ ਮੋਰਨਿੰਗ ਛੇ ਵਜੇ ਭੇਜ ਦੇਣਾ ਜੀ ਧੰਨਵਾਦ